ਹੈਲੋ ਕੀ ਮੈਂ ਗਲੈਕਸੀ ਹੋਟਲ ਦੇ ਮੈਨੇਜਰ ਸਾਹਿਬ ਨਾਲ ਗੱਲ ਕਰ ਰਿਹਾ ਹਾਂ ਸਰ ਜੀ ਮੈਨੂੰ ਇੱਕ ਤੁਹਾਡੇ ਹੋਟਲ ਵਿੱਚ ਟੇਬਲ ਬੁੱਕ ਕਰਨਾ ਹੈ ਕਿਉਂਕਿ ਅੱਜ ਦੇ ਦਿਨ ਮੇਰੇ ਪਿਤਾ ਜੀ ਦਾ ਜਨਮਦਿਨ ਹੈ ਤਾਂ ਅਸੀਂ ਸਾਰੇ ਘਰ ਵਾਲੇ ਰਲ ਮਿਲ ਕੇ ਉਹਨਾਂ ਦੇ ਜਨਮਦਿਨ ਨੂੰ ਮਨਾਉਣ ਵਾਸਤੇ ਤੁਹਾਡੇ ਹੋਟਲ ਵਿੱਚ ਖਾਣ ਪੀਣ ਵਾਸਤੇ ਇੱਕ ਟੇਬਲ ਬੁੱਕ ਕਰਨਾ ਚਾਹੁੰਦੇ ਹਨ ਅਸੀਂ ਲਗਭਗ ਪੰਦਰਾਂ ਸੋਲ੍ਹਾਂ ਜਣੇ ਹੋ ਸਕਦੇ ਹਨ ਸਾਨੂੰ ਉਸ ਦੇ ਹਿਸਾਬ ਨਾਲ ਟੇਬਲ ਬੁੱਕ ਕੀਤਾ ਜਾਵੇ ਅਤੇ ਵਧੀਆ ਸਾਫ਼ ਸਫ਼ਾਈ ਦਾ ਵੀ ਧਿਆਨ ਰੱਖਿਆ ਜਾਵੇ ਅਤੇ ਖਾਣ ਪੀਣ ਵਿੱਚ ਵੀ ਸਾਡੇ ਨਾਲ ਵਧੀਆ ਚੀਜ਼ਾਂ ਦਿੱਤੀਆਂ ਜਾਵੇ ਸਾਨੂੰ ਅਤੇ ਚਾਰ ਤੋਂ ਪੰਜ ਵਜੇ ਤੱਕ ਟੇਬਲ ਨੂੰ ਖਾਲੀ ਕਰ ਦਿੱਤਾ ਜਾਵੇ ਤਾਂ ਕਿ ਅਸੀਂ ਸਾਰੇ ਪਰਿਵਾਰ ਵਾਲੇ ਆ ਕੇ ਬ ਚੰਗੀ ਤਰ੍ਹਾਂ ਨਾਲ ਆਪਣੇ ਜਨ ਪਿਤਾ ਜੀ ਦੇ ਜਨਮ ਦਿਨ ਨੂੰ ਮਨਾਈਏ ਅਤੇ ਖੁਸ਼ੀ ਖੁਸ਼ੀ ਤੁਹਾਡੇ ਤੁਹਾਡੇ ਹੋ ਹੋਟਲ ਵਿੱਚ ਖਾਣਾ ਪੀਣਾ ਛਕੀਏ ਅਤੇ ਘਰ ਜਾਈਏ